ਮੈਂ ਜ਼ਿੰਦਗੀ ਵਿੱਚ ਮੇਰਾਥੋਨਾਂ ਕਾਫੀ ਲਗਾਈਆਂ ਹਨ ਉਹਨਾਂ ਵਿੱਚੋਂ ਇੱਕ ਮੈਰਾਥੋਨ ਮੈਨੂੰ ਜੋ ਕਿ ਬਹੁਤ ਯਾਦ ਹੈ ਉਹ ਬਠਿੰਡੇ ਦੀ ਮੈਰਾਥੋਨ ਹੈ ਜੋ ਕਿ ਇੱਕ ਨਸ਼ਾ ਮੁਕਤ ਪੰਜਾਬ ਲਈ ਕਰਵਾਈ ਗਈ ਸੀ ਪੰਜਾਬ ਸਰਕਾਰ ਵੱਲੋਂ ਉਸ ਨੂੰ ਪ੍ਰਮੋਟ ਕਰਨ ਲਈ ਜਾਂ ਉਸ ਨੂੰ ਵਾਧਾ ਦੇਣ ਲਈ ਬਹੁਤ ਸਾਰੇ ਕਲਾਕਾਰ ਬੁਲਾਏ ਸੀ ਅਤੇ ਹੋਰ ਵੀ ਫੋਰਨ ਤੋਂ ਉਲੰਪੀਅਨ ਬੁਲਾਏ ਗਏ ਜਿਹਨਾਂ ਨੇ ਇਸ ਵਿੱਚ ਭਾਗ ਲੈਣਾ ਸੀ ਅਤੇ ਬਠਿੰਡੇ ਦੇ ਸਾਰੇ ਪ੍ਰਸ਼ਾਸਨ ਨੇ ਇਸ ਮੈਰਾਥੋਨ ਵਿੱਚ ਭਾਗ ਲਿਆ ਏਡੀਸੀ ਸਾਹਿਬ ਐਸਡੀਐਮ ਸਾਹਿਬ ਕਲੈਕਟਰ ਸਾਹਿਬ ਕਮਿਸ਼ਨਰ ਸਾਹਿਬ ਵੀ ਫਿਰੋਜਪੁਰ ਤੋਂ ਆਏ ਹੋਏ ਸੀ ਇਸ ਮੈਰਾਥੋਨ ਦਾ ਮੇਨ ਮਕਸਦ ਸੀ ਕਿ ਲੋਕਾਂ ਨੂੰ ਭੱ ਭੱਜਣਾ ਰਨਿੰਗ ਕਰਨੀ ਅਤੇ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਤਾਂ ਕਿ ਆਪਣੀ ਜਿਹੜੀ ਰਨਿੰਗ ਹੈ ਉਹ ਕੈਂਸਰ ਸੈੱਲ ਸਾਰੇ ਬਰਨ ਕਰਦੀ ਹੈ ਜਾਂ ਹੋਰ ਵੀ ਤਰੀਕੇ ਦੀਆਂ ਬਿਮਾਰੀਆਂ ਤੋਂ ਆਪਾਂ ਨੂੰ ਦੂਰ ਰੱਖਦੀ ਹੈ ਉਸ ਮੈਰਾਥੋਨ ਕਰੀਬ ਉਹ ਬੱਤੀ ਕਿਲੋਮੀਟਰ ਦੀ ਮੈਰਾਥੋਨ ਸੀ ਜਿਸ ਵਿੱਚ ਸਾਨੂੰ ਨਾਲ ਸਾਈਕਲ ਸਪੈਸ਼ਲਿਸਟ ਵੀ ਇੰਕਲੂਡ ਕਰਵਾਏ ਸੀ ਜੋ ਸਾਨੂੰ ਭੱਜਣ ਦੇ ਦੌਰਾਨ ਵੱਖ ਵੱਖ ਜਗ੍ਹਾ 'ਤੇ ਸਾਨੂੰ ਪਾਣੀ ਦੀ ਸੁਵਿਧਾ ਕਰਵਾਉਂਦੇ ਸੀ ਇਹ ਰਿਫਰੈਸ਼ਮੈਂਟ ਕਰਵਾਉਂਦੇ ਸੀ ਅਤੇ ਸਾਨੂੰ ਜਦੋਂ ਮੇਰਾਥੋਨ ਕਰਦੇ ਸੀ ਤਾਂ ਐਨਰਜੀ ਡਰਿੰਕਸ ਵੀ ਮੁਹੱਈਆ ਕਰਵਾਉਂਦੇ ਸੀ ਉਹ ਮੈਨੂੰ ਇਸ ਲਈ ਯਾਦ ਹੈ ਕਿਉਂਕਿ ਉਸ ਲਈ ਇੱਕਵੰਜਾ ਹਜ਼ਾਰ ਰੁਪਇਆ ਇਨਾਮ ਰੱਖਿਆ ਸੀ ਵਿਨਰ ਲਈ ਤਾਂ ਉਸ ਲਈ ਬਹੁਤ ਸਾਰੇ ਕੀਨੀਆ ਤੋਂ ਆਏ ਲੋਕ ਜਾਂ ਹੋਰ ਜਗ੍ਹਾ ਤੋਂ ਆਏ ਲੋਕ ਵੀ ਬਹੁਤ ਉਤਸਾਹੀ ਸੀ ਉਸ ਦੌਰਾਨ ਰਨਿੰਗ ਦੌਰਾਨ ਮੈਨੂੰ ਯਾਦ ਹੈ ਕਿ ਐਂਡ ਦੇ ਤਿੰਨ ਕਿਲੋਮੀਟਰ ਚਾਰ ਕਿਲੋਮੀਟਰ ਵਿੱਚ ਮੈਂ ਹਮੇਸ਼ਾ ਮੈਂ ਤਿੰਨ ਚਾਰ ਕਿਲੋਮੀਟਰ ਦੀ ਰਨਿੰਗ ਦੇਖੀ ਹੈ ਸਪਰਿੰਟ ਮੈਂ ਕਦੇ ਨਹੀਂ ਦੇਖੀ ਤਾਂ ਉਹ ਕੀਨੀਆ ਦੇ ਵਿੱਚ ਫਾਈਟ ਹੋ ਚੱਲੀ ਐਂਡ 'ਤੇ ਵੀ ਕੌਣ ਰੇਸ ਨੂੰ ਕੱਢੇਗਾ ਅਤੇ ਜਿੱਤ ਪ੍ਰਾਪਤ ਕਰੇਗਾ ਤਾਂ ਉਸ ਦੇ ਵਿੱਚ ਕੀ ਹੈ ਐਡ ਵਾਲੇ ਚਾਰ ਕਿਲੋਮੀਟਰ ਲਗਾਤਾਰ ਸਪਰਿੰਟ ਚੱਲੀ ਜਿਸ ਵਿੱਚ ਕੀ ਕੀਨੀਅਨ ਅੱਠ ਜਣੇ ਸੀਗੇ ਅਤੇ ਅੱਠ ਦੇ ਵਿੱਚੋਂ ਪਹਿਲੀ ਤਿੰਨ ਦੋ ਪੁਜੀਸ਼ਨਾਂ 'ਤੇ ਓਲੰਪਿਕ ਮੈਰਾਥੋਨ ਰੰਨਰ ਆਏ ਇੱਕ ਪੁਜੀਸ਼ਨ 'ਤੇ ਇੰਡੀਆ ਦਾ ਇੱਕ ਆਂਧਰਾ ਪ੍ਰਦੇਸ਼ ਦਾ ਵਸਨੀਕ ਲੜਕੇ ਨੇ ਤੀਜੇ ਹਾਸਲ ਪ੍ਰਾਪਤ ਕੀਤੀ ਜੋ ਕਿ ਇੱਕ ਦੇਖ ਨੇ ਉਹ ਦਰਸੀ